ਪੰਜਾਬ ਦੀ ਸੱਤਰ ਪ੍ਰਸੈਂਟ ਤੋਂ ਜ਼ਿਆਦਾ ਆਬਾਦੀ ਜੋ ਕਿ ਖੇਤੀਬਾੜੀ ਸੈਕਟਰ 'ਤੇ ਨਿਰਭਰ ਹੈ ਜਿਸ ਵਿੱਚ ਛੋਟੇ ਕਿਸਾਨ ਜ਼ਿਆਦਾਤਰ ਛੋਟੇ ਕਿਸਾਨ ਹੀ ਹਨ ਜਾਂ ਮਜ਼ਦੂਰ ਜੋ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਉਹ ਵੀ ਖੇਤੀਬਾੜੀ 'ਤੇ ਨਿਰਭਰ ਹਨ ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਬਾਰੇ ਜੇ ਦੱਸਿਆ ਜਾਵੇ ਉਹ ਕਿਵੇਂ ਕਿਸ ਤਰ੍ਹਾਂ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਵੱਧਦੀ ਅਬਾਦੀ ਬਾਰੇ ਅਤੇ ਖਾਦ ਦੀ ਪੂਰਤੀ ਲਈ ਖੇਤੀਬਾੜੀ ਸੈਕਟਰ 'ਤੇ ਹੀ ਸਾਨੂੰ ਨਿਰਭਰ ਹੋਣਾ ਪਵੇਗਾ ਉਸ ਦੇ ਲਈ ਜਮੀਨ ਦੀ ਉਪਜਾਊ ਸ਼ਕਤੀ ਅਤੇ ਵਧੀਆ ਤਰ੍ਹਾਂ ਦੇ ਬੀਜ ਸਾਨੂੰ ਪੈਦਾ ਕਰਨੇ ਪੈਣਗੇ ਜੋ ਤਾਂ ਜੋ ਖੇਤੀਬਾੜੀ ਤੋਂ ਵਧੇਰੇ ਉਪਜ ਪੈਦਾ ਕਰਕੇ ਅਸੀਂ ਵੱਧ ਦੀ ਅਬਾਦੀ ਲਈ ਖਾਣੇ ਦਾ ਪ੍ਰਬੰਧ ਕਰ ਸਕੀਏ